ਜੀ ਨਹੀਂ ਮੈਨੂੰ ਪੰਜਾਬੀ ਬੋਲਣ ਵਿੱਚ ਕਦੇ ਵੀ ਕੋਈ ਦਿੱਕਤ ਨਹੀਂ ਆਈ ਕਿਉਂਕਿ ਪੰਜਾਬੀ ਮੇਰੀ ਮਾਂ ਬੋਲੀ ਹੈ ਮੈਂ ਜਨਮ ਤੋਂ ਹੀ ਆਪਣੇ ਘਰ ਵਿੱਚ ਅਤੇ ਆਪਣੇ ਆਲੇ ਦੁਆਲੇ ਤੋਂ ਪੰਜਾਬੀ ਸਿੱਖਦਾ ਆਇਆ ਹਾਂ ਸ਼ੁਰੂ ਤੋਂ ਹੀ ਮੈਨੂੰ ਘਰ ਦਾ ਮਾਹੌਲ ਸੀ ਜਿਹੜਾ ਉਹ ਪੰਜਾਬੀ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ ਅਤੇ ਪੰਜਾਬੀ ਹੀ ਮੇਰੀ ਮਾਂ ਬੋਲੀ ਹੈ ਇਸ ਤੋਂ ਬਾਅਦ ਮੈਂ ਸਰਕਾਰੀ ਸਕੂਲ ਵਿੱਚ ਦਾਖਲ ਹੋਇਆ ਜਿੱਥੇ ਕਿ ਮੇਰਾ ਮੀਡੀਅਮ ਵੀ ਪੰਜਾਬੀ ਸੀ ਮੈਂ ਸਾਰੇ ਸਬਜੈਕਟ ਪੰਜਾਬੀ ਮੀਡੀਅਮ ਦੇ ਵਿੱਚ ਹੀ ਪੜ੍ਹੇ ਹਨ ਇਸ ਤੋਂ ਬਾਅਦ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਨੂੰ ਨੌਕਰੀ ਮਿਲੀ ਅਤੇ ਮੈਂ ਪੰਜਾਬੀ ਅਧਿਆਪਕ ਦੀ ਪੋਸਟ 'ਤੇ ਹੀ ਲੱਗਿਆ ਹੋਇਆ ਹਾਂ ਮੈਂ ਲਗਭਗ ਪਿਛਲੇ ਅਠਾਰਾਂ ਸਾਲਾਂ ਤੋਂ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾ ਰਿਹਾ ਹਾਂ ਮੈਂ ਪੂਰੀ ਤਰ੍ਹਾਂ ਪੰਜਾਬੀ ਨਾਲ ਜੁੜਿਆ ਹੋਇਆ ਹਾਂ ਪੰਜਾਬੀ ਦੀਆਂ ਮੈਂ ਬਹੁਤ ਸਾਰੀਆਂ ਕਾਨਫਰੰਸਾਂ ਸੈਮੀਨਾਰ ਅਟੈਂਡ ਕੀਤੇ ਹਨ ਇਸ ਤੋਂ ਇਲਾਵਾ ਮੈਨੂੰ ਪੰਜਾਬੀ ਸੱਭਿਆਚਾਰ ਪੰਜਾਬੀ ਸ਼ਿੰਗਾਰ ਪੰਜਾਬੀ ਗੀਤ ਅਤੇ ਪੰਜਾਬੀ ਬੋਲੀਆਂ ਅਤੇ ਪੰਜਾਬੀ ਦੇ ਸ ਇਤਿਹਾਸ ਸਾਹਿਤ ਨਾਲ ਬਾਰੇ ਡੂੰਘੀ ਜਾਣਕਾਰੀ ਰੱਖਦਾ ਹਾਂ ਮੈਂ ਬੱਚਿਆਂ ਨੂੰ ਸ਼ੁੱਧ ਪੰਜਾਬੀ ਲਿਖਣ ਦੇ ਲਈ ਉਤਸ਼ਾਹਿਤ ਕਰਦਾ ਹਾਂ ਅਤੇ ਆਪਣੇ ਪੀਰੀਅਡ ਦੇ ਦੌਰਾਨ ਹਮੇਸ਼ਾ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਸਕਾਂ ਸ਼ੁੱਧ ਪੰਜਾਬੀ ਲਿਖਣ ਅਤੇ ਪੜ੍ਹਣ ਦੇ ਲਈ ਮੈਂ ਹਰ ਸਮੇਂ ਯਤਨ ਕਰਦਾ ਹਾਂ ਛੋਟੇ ਬੱਚੇ ਜਿਹੜੇ ਕਿ ਜਿਹਨਾਂ ਨੂੰ ਕਿ ਪੰਜਾਬੀ ਬੋਲਣ ਦੇ ਵਿੱਚ ਮੁਸ਼ਕਿਲ ਆਉਂਦੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਅਲੱਗ ਤੋਂ ਸਮਾਂ ਦੇ ਕੇ ਉਹਨਾਂ ਨੂੰ ਸ਼ੁੱਧ ਪੰਜਾਬੀ ਲਿਖਣ ਅਤੇ ਬੋਲਣ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ ਮੇਰੀਆਂ ਕੋਸ਼ਿਸ਼ਾਂ ਦਾ ਨਤੀਜਾ ਇਹ ਹੋਇਆ ਹੈ ਕਿ ਬਹੁਤ ਸਾਰੇ ਬੱਚੇ ਜੋ ਪਹਿਲਾਂ ਪੰਜਾਬੀ ਬੋਲਣ ਵਿੱਚ ਮੁਸ਼ਕਿਲ ਆਉਂਦੀ ਸੀ ਉਹ ਹੁਣ ਬੜੇ ਆਰਾਮ ਦੇ ਨਾਲ ਪੰਜਾਬੀ ਬੋਲ ਪਾਉਂਦੇ ਹਨ ਮੇਰੇ ਨਤੀਜੇ ਪੰਜਾਬੀ ਵਿਸ਼ੇ ਦੇ ਹਰ ਸਾਲ ਬਹੁਤ ਚੰਗੇ ਆਉਂਦੇ ਹਨ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਮੇਰਾ ਜਨਮ ਪੰਜਾਬ ਵਿੱਚ ਹੋਇਆ ਹੈ ਅਤੇ ਪੰਜਾਬੀ ਮੇਰੀ ਮਾਂ ਬੋਲੀ ਹੈ ਅਤੇ ਮੈਨੂੰ ਪੰਜਾਬੀ ਬੋਲਣ ਦੇ ਵਿੱਚ ਕਿਸੇ ਕਿਸਮ ਦੀ ਕੋਈ ਘਬਰਾਹਟ ਦਿੱਕਤ ਨਹੀਂ ਹੈ